ਯੋਗਾ ਸਿਰਫ ਕਸਰਤ ਦਾ ਇੱਕ ਰੂਪ ਨਹੀਂ ਹੈ ਇੱਕ ਪ੍ਰਕਿਰਿਆ ਹੈ ਜਿੱਦਾਂ ਕਿ ਕੋਈ ਵੀ ਕੰਮ ਕਰਨਾ ਹੋਏ ਤਾਂ ਉਹਦੀ ਪ੍ਰਕਿਰਿਆ ਹੁੰਦੀ ਹੈ ਅਤੇ ਇੱਕ ਪ੍ਰਕਿਰਿਆ ਹੀ ਜ਼ਿੰਦਗੀ ਜਿਉਣ ਦਾ ਇੱਕ ਰੂਪ ਹੈ ਜਿਸ ਨਾਲ ਅਸੀਂ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜੀਅ ਸਕਦੇ ਹਾਂ ਜਿਸ ਤਰ੍ਹਾਂ ਅਸੀਂ ਖਾਂਦੇ ਹਾਂ ਪੀਂਦੇ ਹਾਂ ਵੱਖਰੇ ਵੱਖਰੇ ਕੰਮ ਕਰਦੇ ਖੇਡਦੇ ਕੁੱਦ ਦੇ ਸਾਰਾ ਕੁਝ ਉਸੇ ਹੀ ਤਰ੍ਹਾਂ ਇੱਕ ਯੋਗਾ ਜ਼ਿੰਦਗੀ ਜਿਉਣ ਦਾ ਤਰੀਕਾ ਹੈ ਪਹਿਲੇ ਸਮੇਂ ਵਿੱਚ ਇਹ ਹਰ ਇੱਕ ਜੀਵਨ ਬੰਦੇ ਦੀ ਜ਼ਿੰਦਗੀ ਦਾ ਹਿੱਸਾ ਹੁੰਦਾ ਸੀ ਪਰ ਅੱਜ ਦੇ ਆਧੁਨਿਕ ਸਮੇਂ ਵਿੱਚ ਇਨਸਾਨ ਕੋਲ ਸਮਾਂ ਨਹੀਂ ਹੈ ਜਿਸ ਦੇ ਕਾਰਨ ਉਹ ਇਹਨਾਂ ਨੂੰ ਇੱਕ ਪਿੱਛੇ ਛੱਡਦਾ ਜਾ ਰਿਹਾ ਤਾਂ ਉਹਨਾਂ ਨੇ ਇਸਦੇ ਇਸਨੂੰ ਇੱਕ ਵਧੀ ਹੋਏ ਇਸ ਤਰ੍ਹਾਂ ਦੀ ਚੀਜ਼ ਬਣਾ ਤੀ ਹੈ ਕਿ ਕਸਰਤ ਦਾ ਰੂਪ ਹੈ ਜਿਸ ਨੂੰ ਕਰੋ ਨਾ ਕਰੋ ਪਰ ਇਹ ਇਸ ਤਰ੍ਹਾਂ ਦੇ ਵਿੱਚ ਨਹੀਂ ਸੀ ਜਦੋਂ ਇਹ ਸ਼ੁਰੂ ਹੋਇਆ ਸੀ ਅਤੇ ਇਹ ਇੱਕ ਇਸ ਤਰ੍ਹਾਂ ਦੀ ਚੀਜ਼ ਸੀ ਅਤੇ ਇਨਸਾਨੀ ਜੀਵਨ ਵਿੱਚ ਸ਼ਾਮਿਲ ਸੀ ਉਹ ਨਿੱਤ ਸਵੇਰੇ ਉੱਠ ਕੇ ਸਾਰਿਆਂ ਨਾਲੋਂ ਪਹਿਲਾਂ ਯੋਗਾ ਕਰਦਾ ਸੀ ਜਿਸ ਨਾਲ ਉਹਦਾ ਮਾਇੰਡ ਫਰੈਸ਼ ਹੁੰਦਾ ਇਹਦੇ ਨਾਲ ਇਹ ਨਹੀਂ ਹੈ ਕਿ ਸਿਰਫ ਤੁਹਾਡਾ ਸਰੀਰ ਠੀਕ ਰਹਿੰਦਾ ਤੁਹਾਡਾ ਮਾਨਸਿਕ ਰੂਪ 'ਤੇ ਤੁਹਾਡਾ ਮਾ ਦਿਮਾਗ ਬਲ ਇੰਨਾਂ ਜ਼ਿਆਦਾ ਹੋ ਜਾਂਦਾ ਕਿ ਤੁਸੀਂ ਕਿਸੇ ਵੀ ਮੁਸ਼ਕਿਲ ਪ੍ਰਸਥਿਤੀ ਤੋਂ ਬਾਹਰ ਨਹੀਂ ਸ ਸਕਦੇ ਹੋ ਕਿਸੇ ਵੀ ਵੱਡੀ ਤੋਂ ਵੱਡੀ ਮੁਸ਼ਕਿਲ ਦਾ ਹੱਲ ਲੱਭ ਸਕਦੇ ਹੋ ਅਤੇ ਤੁਸੀਂ ਕਿਸੇ ਬੰਦੇ ਨਾਲ ਕਿੱਦਾਂ ਡੀਲ ਕਰਨਾ ਕਿਸੇ ਬੰਦੇ ਤੋਂ ਕੰਮ ਕਰਾਉਣਾ ਕਿੱਦਾਂ ਕੰਮ ਕਰਨਾ ਕਿੱਦਾਂ ਜ਼ਿੰਦਗੀ ਨੂੰ ਵਧੀਆ ਜਿਉਣਾ ਹੈ ਮੁਸ਼ਕਿਲਾਂ ਤੋਂ ਪਰੇ ਹਟਣਾ ਮੁਸ਼ਕਿਲਾਂ ਤੋਂ ਅੱਗੇ ਆਉਣਾ ਸਭ ਕੁਝ ਸਿੱਖ ਸਕਦੇ ਹੋ ਤੁਸੀਂ ਇਹ ਸਿਰਫ ਕਸਰਤ ਤੋਂ ਹੱਟ ਕੇ ਨਹੀਂ ਇਹ ਦਿਮਾਗੀ ਮਾਨਸਿਕ ਹਰ ਚੀਜ਼ ਜ਼ਿੰਦਗੀ ਜਿਉਣਾ ਮੁਸ਼ਕਿਲਾਂ ਸਭ ਕੁਝ ਤੋਂ ਉੱਪਰ ਉੱਠ ਕੇ ਤੁਸੀਂ ਇੱਕ ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖਦੇ ਹੋ